ਅਸੀਂ ਪਹਿਲਾਂ ਜੇ ਪਾਣੀ ਰੁੱਕਦਾ ਹੈ ਤਾਂ ਉਹਦੀ ਸ਼ਿੰਕ ਵਿੱਚ ਪਹਿਲਾਂ ਤਾਰਾਂ ਮਾਰਾਂਗੇ ਜੇ ਉਹ ਤਾਰ ਨਾਲ ਪਾਣੀ ਨਹੀਂ ਨਿਕਲਦਾ ਜੇ ਉਹਦੇ ਵਿੱਚ ਪਾਈਪ ਵਿੱਚ ਕੁਛ ਫਸਿਆ ਹੋਇਆ ਹੈ ਪਾਈਪਾਂ ਦੇ ਵਿੱਚ ਕੁਛ ਫਸਿਆ ਹੈ ਤਾਂ ਫਿਰ ਅਸੀਂ ਉਹਦਾ ਪਾਈਪ ਉਤਾਰ ਕੇ ਫਿਰ ਉਹਦੀ ਸਫਾਈ ਕਰਾਂਗੇ ਖੋਲ੍ਹ ਕੇ ਉਹਨੂੰ ਪਾਈਪ ਨੂੰ ਫਿਰ ਜੇ ਅਗਰ ਨਹੀਂ ਹੁੰਦਾ ਹੈ ਤਾਂ ਤਾਂ ਸੰਪਰਕ ਕਰਾਂਗੇ ਆਪਣੇ ਸਾਰੇ ਮਤਲਬ ਜਿਹੜੇ ਸਫਾਈ ਕਰਮਚਾਰੀ ਟੈਕਨੀਸ਼ੀਆ ਦੇ ਦੌਰੇ ਲਈ